ਹੈਲੋ ਹਾਂਜੀ ਤੁਸੀਂ ਟਰਾਂਸਪੋਰਟ ਏਜੰਸੀ ਤੋਂ ਗੱਲ ਕਰ ਰਹੇ ਹੋ ਮੈਂ ਕੈਬ ਬੁੱਕ ਕਰਾਉਣਾ ਚਾਹੁੰਦੀ ਹਾਂ ਕੀ ਤੁਸੀਂ ਮੈਨੂੰ ਕੈਬ ਦੇ ਵਿੱਚ ਅੰਤਰ ਦੱਸ ਸਕਦੇ ਹੋ ਕਿ ਵੱਡੀ ਆਕਾਰ ਦੀ ਕੈਬ ਅਤੇ ਛੋਟੀ ਆਕਾਰ ਦੀ ਕੈਬ ਦੇ ਵਿੱਚ ਕੀ ਅੰਤਰ ਹੈ ਅਸੀਂ ਆਪਣੀ ਯਾਤਰਾ ਕਰਨਾ ਚਾਹੁੰਦੇ ਹਾਂ ਆਪਣੇ ਪਰਿਵਾਰ ਦੇ ਸਮੇਤ ਅਸੀਂ ਆਪਣੇ ਪਰਿਵਾਰ ਨਾਲ ਨੇੜੇ ਸਥਾਨ 'ਤੇ ਯਾਤਰਾ ਲਈ ਜਾਣਾ ਚਾਹੁੰਦੇ ਹਾਂ ਯਾਤਰਾ ਕਰਨ ਵਾਲੇ ਮੈਂਬਰਾਂ ਦੀ ਗਿਣਤੀ ਚਾਰ ਤੋਂ ਛੇ ਹੈ ਜੇਕਰ ਅਸੀਂ ਚਾਰ ਮੈਂਬਰ ਜਾਂਦੇ ਹਾਂ ਤਾਂ ਕਿਹੜੀ ਕੈਬ ਚਾਰ ਲੋਕਾਂ ਨੂੰ ਫਿੱਟ ਕਰਦੀ ਹੈ ਅਤੇ ਜੇਕਰ ਅਸੀਂ ਛੇ ਲੋਕ ਜਾਂਦੇ ਹਾਂ ਤਾਂ ਕਿਹੜੀ ਕੈਬ ਛੇ ਲੋਕਾਂ ਨੂੰ ਫਿੱਟ ਕਰਦੀ ਹੈ ਅਤੇ ਮੈਨੂੰ ਇਹਨਾਂ ਦੀ ਕੀਮਤ ਬਾਰੇ ਵੀ ਦੱਸਿਆ ਜਾਵੇ ਕਿ ਜੇਕਰ ਚਾਰ ਮੈਂਬਰਾਂ ਵਾਲੀ ਕੈਬ ਲੈਂਦੇ ਹਾਂ ਤਾਂ ਉਸ ਦੀ ਕੀਮਤ ਕੀ ਹੋਊਗੀ ਅਤੇ ਜੇਕਰ ਅਸੀਂ ਛੇ ਮੈਂਬਰਾਂ ਨੂੰ ਫਿੱਟ ਕਰਨ ਵਾਲੀ ਕੈਬ ਲੈਂਦੇ ਹਾਂ ਤਾਂ ਉਸ ਦੀ ਕੀ ਕੀਮਤ ਹੋਊਗੀ ਅਤੇ ਇਹਨਾਂ ਦੇ ਵਿੱਚ ਅੰਤਰ ਕੀ ਹੋਊਗਾ ਤਾਂ ਕਿ ਸਾਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਸ ਦੀ ਕੀਮਤ ਬਾਰੇ ਦੱਸਿਆ ਜਾਵੇ ਕਿਰਪਾ ਕਰਕੇ ਮੈਨੂੰ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਸਾਨੂੰ ਆਪਣੀ ਯਾਤਰਾ ਕਰਨ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਧੰਨਵਾਦ ਜੀ